ਪਸ਼ੂ ਦੇ ਗਰਭ ਦੌਰਾਨ ਸਾਨੂੰ ਬਹੁਤ ਹੀ ਸਾਰੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਕਿ ਜਦੋਂ ਪਸ਼ੂ ਗਰਭ ਦੇਹੀ ਅਵਸਥਾ 'ਚ ਹੁੰਦਾ ਹੈ ਤਾਂ ਉਹਨੂੰ ਟਾਈਮ ਸਿਰ ਦਾਣਾ ਅਤੇ ਉਹਦੇ ਜੋ ਵੀ ਲੋੜਵੰਦ ਚੀਜ਼ ਜਿਵੇਂ ਦਾਣਾ ਚੰਗੀ ਕੁਆਲਿਟੀ ਦਾ ਪਾਣੀ ਟਾਈਮ ਸਿਰ ਅਤੇ ਉਹਦੇ ਥੱਲੇ ਪੋਲਾ ਥਾਂ ਰੱਖਣਾ ਚਾਹੀਦਾ ਹੈ ਤਾਂ ਕਿ ਜੋ ਪਸ਼ੂ ਨੂੰ ਖੜਣ ਅਤੇ ਬੈਠਣ 'ਚ ਕੋਈ ਦਿੱਕਤ ਨਾ ਹੋਵੇ ਇਹਦੇ ਵਿੱਚ ਮੇਨ ਧਿਆਨ ਇਹ ਰੱਖਣਾ ਚਾਹੀਦਾ ਹੈ ਕਿ ਆਪਣਾ ਪਸ਼ੂ ਕਿਸੇ ਵੀ ਤਰੀਕੇ ਕਾਰਨ ਬਿਮਾਰ ਨਾ ਹੋਵੇ ਜਿਵੇਂ ਕਿ ਪਸ਼ੂ ਥੋੜ੍ਹਾ ਜਿਹਾ ਦੁਗਲਾ ਪਤਲਾ ਹੈ ਤਾਂ ਉਸ ਨੂੰ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ ਤਾਂ ਕੋਈ ਜੋ ਬਾਜ਼ਾਰ ਵਿੱਚੋਂ ਇੱਕ ਕੈਲਸ਼ੀਅਮ ਦੀ ਪੰਜ ਲੀਟਰ ਵਾਲੀ ਕੈਨੀ ਆਉਂਦੀ ਹੈ ਉਹ ਲਿਆ ਕੇ ਪਸ਼ੂ ਨੂੰ ਦੇਣੀ ਦਿਓ ਅਤੇ ਨਾਲ ਉਸਨੂੰ ਸਰ੍ਹੋਂ ਦਾ ਤੇਲ ਵੀ ਦੇਣਾ ਚਾਹੀਦਾ ਹੈ ਤਾਂ ਜੋ ਪਸ਼ੂ ਨੂੰ ਗਰਭ ਦੌਰਾਨ ਕੋਈ ਦਿੱਕਤ ਨਾ ਹੋਵੇ ਜਦੋਂ ਪਸ਼ੂ ਜਨਮ ਦਿੰਦਾ ਹੈ ਤਾਂ ਉਸ ਟਾਈਮ ਵਿਸ਼ੇਸ਼ ਧਿਆਨ ਇਹ ਰੱਖਣ ਦੀ ਜ਼ਰੂਰਤ ਪੈਂਦੀ ਹੈ ਕਿ ਪਸੂ ਦੇ ਕੋਲ ਤਿੰਨ ਚਾਰ ਬੰਦੇ ਲਾਜ਼ਮੀ ਹੋਣੇ ਚਾਹੀਦੇ ਹਨ ਕਿਉਂਕਿ ਜਦੋਂ ਪਸ਼ੂ ਜਨਮ ਦਿੰਦਾ ਹੈ ਤਾਂ ਉਦੋਂ ਉਸ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਹੱਲ ਕਰਨਾ ਪੈਂਦਾ ਹੈ ਪਸ਼ੂ ਇਕੱਲਾ ਹੀ ਬੱਚੇ ਨੂੰ ਜਨਮ ਨਹੀਂ ਦੇ ਸਕਦਾ ਇਸ ਕਰਕੇ ਉਹਦੇ ਕੋਲ ਬੰਦਿਆਂ ਦੀ ਜ਼ਰੂਰਤ ਤਾਂ ਪੈਂਦੀ ਹੈ ਕਿ ਜੋ ਉਸ ਅੰਦਰ ਬੁਲਬੁਲਾ ਬਣਿਆ ਹੁੰਦਾ ਹੈ ਉਹਨੂੰ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪਾੜ ਕੇ ਉਸ ਬੱਚੇ ਵਸ਼ਰੂ ਦੀਆਂ ਲੱਤਾਂ ਬਾਹਰ ਕੱਢੀਆਂ ਪੈਂਦੀਆਂ ਹਨ ਲੱਤਾਂ ਬਾਹਰ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਖਿੱਚਣਾ ਪੈਂਦਾ ਹੈ ਤਾਂ ਕਿ ਖਿੱਚਣ ਦੇ ਨਾਲ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਬਹੁਤੇ ਹੀ ਸਹੀ ਤਰੀਕੇ ਨਾਲ ਇਹ ਟ੍ਰੀਟਮੈਂਟ ਕਰਨਾ ਚਾਹੀਦਾ ਹੈ ਤਾਂ ਕਿ ਜੋ ਮਾਂ ਅਤੇ ਬੱਚੇ ਨੂੰ ਦੋਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਜਿਸ ਜਿਸ ਵਿੱਚ ਜਦੋਂ ਬੱਚਾ ਹੋ ਜਾਂਦਾ ਹੈ ਤਾਂ ਪਸ਼ੂ ਦੇ ਅੱਗੇ ਰੱਖਣਾ ਚਾਹੀਦਾ ਹੈ ਅਤੇ ਉਹ ਉਹਨੂੰ ਉਹਦੇ ਉੱਪਰ ਲੱਗੇ ਜਾਲੇ ਸਾਫ ਕਰ ਦਿੰਦੇ ਹਨ ਅਤੇ ਨਾਲ ਹੀ ਬੱਚੇ ਦੇ ਕੰਨਾਂ ਵਿੱਚ ਫੂਕਾਂ ਮਾਰਨੀਆਂ ਚਾਹੀਦੀਆਂ ਹਨ